ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਨੇ ਜੋ ਦਿਲਚਸਪ ਨੇ ਅਤੇ ਇੱਦਾਂ ਦੀਆਂ ਬਹੁਤ ਘਟਨਾਵਾਂ ਹੋਣਗੀਆਂ ਵੀ ਜੋ ਅੱਗੇ ਜਾ ਕੇ ਵੀ ਮੈਨੂੰ ਦਿਲਚਸਪ ਲੱਗਣੀਆਂ ਗੇ ਦੋ ਹਜ਼ਾਰ ਬਾਰ੍ਹਾਂ ਦੀ ਗੱਲ ਹੈ ਦੋ ਹਜ਼ਾਰ ਹਾਂ ਬਾਰ੍ਹਾਂ ਤੇਰ੍ਹਾਂ ਦੀ ਗੱਲ ਹੈ ਉਦੋਂ ਨਾ ਮੈਂ ਹੇਮਕੁੰਡ ਸਾਹਿਬ ਗਿਆ ਸੀਗਾ ਹੇਮਕੁੰਡ ਸਾਹਿਬ ਇੱਥੇ ਅਸੀ ਘਰ ਤੋਂ ਤੁਰੇ ਸੀਗੇ ਅਤੇ ਅੱਗੇ ਜ ਜਦੋਂ ਅਸੀਂ ਪਾਉਂਟਾ ਸਾਹਿਬ ਪਹੁੰਚੇ ਪਹਿਲਾਂ ਉੱਥੋਂ ਮੱਥਾ ਟੇਕਿਆ ਅਤੇ ਉੱਥੇ ਯਮੁਨਾ ਨਦੀ ਦੇ ਵਿੱਚ ਅਸੀਂ ਇਸ਼ਨਾਨ ਵੀ ਕੀਤਾ ਅਤੇ ਉਸ ਤੋਂ ਅੱਗੇ ਜਦੋਂ ਅਸੀਂ ਵਧੇ ਅੱਗੇ ਅਸੀਂ ਪਹੁੰਚੇ ਆਪਣੇ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਅੱ ਫਿਰ ਅਸੀਂ ਇੱਕ ਰਾਤ ਉੱਥੇ ਰਹੇ ਰਾਤ ਉੱਥੇ ਕੱਟੀ ਆਪਣੀ ਅਤੇ ਉੱਥੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਅੱਗੇ ਅਸੀਂ ਅੱਗੇ ਨਿਕਲ ਗਏ ਆਪਣਾ ਗੋਬਿੰਦ ਘ ਧਾਮ ਗੋਵਿੰਦ ਧਾਮ ਤੋਂ ਅਸੀਂ ਉੱਪਰ 'ਚ ਗੋਬਿੰਦ ਧਾਮ ਤੱਕ ਗੱਡੀ 'ਤੇ ਜਾਂਦਾ ਹੈ ਉਸ ਤੋਂ ਬਾਅਦ ਪੈਦਲ ਚੜਾਈ ਸ਼ੁਰੂ ਹੋ ਜਾਂਦੀ ਹੈ ਅਠਾਰ੍ਹਾਂ ਕਿਲੋਮੀਟਰ ਦੀ ਉਹ ਅਸੀਂ ਪੈਦਲ ਚੜਾਈ ਕੀਤੀ ਅਤੇ ਅਸੀਂ ਪਹੁੰਚ ਗਏ ਗੋਬਿੰਦ ਧਾ ਘਾਟ ਤੋਂ ਧਾਮ ਅਤੇ ਉਸ ਤੋਂ ਬਾਅਦ ਅੱਗੇ ਛੇ ਕਿਲੋਮੀਟਰ ਦੀ ਚੜਾਈ ਹੈ ਅਤੇ ਅਸੀਂ ਉੱਥੇ ਪਹੁੰਚ ਗਏ ਅਤੇ ਉਹਦੇ ਵਿੱਚ ਰਸਤੇ ਵਿੱਚ ਗਲੇਸ਼ੀਅਰ ਵੀ ਆਉਂਦਾ ਜਿਹੜਾ ਕਿ ਦੇਖਣ ਨੂੰ ਬਹੁਤ ਵਧੀਆ ਲੱਗਦਾ ਅਤੇ ਉੱਥੇ ਦਾ ਮੌਸਮ ਹੈ ਜਿਹੜਾ ਉਹ ਬਹੁਤ ਜ਼ਿਆਦਾ ਠੰਡਾ ਹੁੰਦਾ ਅਤੇ ਉੱਥੇ ਪਹਾੜਾਂ 'ਚ ਜਾ ਕੇ ਸਾਨੂੰ ਇੱਦਾਂ ਲੱਗਦਾ ਵੀ ਬਹੁਤ ਵਧੀਆ ਫੀਲਿੰਗ ਆਉਂਦੀ ਹੈ ਉੱਥੇ ਪਹਾੜਾਂ 'ਚ ਜਾ ਕੇ ਅਤੇ ਉੱਥੇ ਨਾ ਇੱਕ ਫੁੱਲਾਂ ਦੀ ਘਾਟੀ ਹੈ ਜਿੱਥੇ ਕਿ ਹਜ਼ਾਰਾਂ ਪਤਾ ਨਹੀਂ ਕਿੰਨੇ ਹੀ ਕਰੋੜਾਂ ਮਤਲਬ ਇੰਨੇ ਬਹੁਤ ਜ਼ਿਆਦਾ ਫੁੱਲ ਨੇ ਜਿਹੜੇ ਕਿ ਅਸੀਂ ਆਪਣੀ ਜ਼ਿੰਦਗੀ 'ਚ ਕਦੇ ਦੇਖੇ ਵੀ ਨਹੀਂ ਸੀਗੇ ਅਤੇ ਇੱਦਾਂ ਦੇ ਵੀ ਸ ਉਹ ਫਲ ਨੇ ਉਹ ਹੈਗੇ ਨੇ ਵੀ ਜਿਨ੍ਹਾਂ ਦਾ ਇਹਨੂੰ ਹੱਥ ਲਾਏ ਤੋਂ ਬੰਦੇ ਨੂੰ ਜੇ ਮਤਲਬ ਸਹੀ ਸਮੇਂ ਸਿਰ ਹੋਸਪਿਟਲ ਨਾ ਪਹੁੰਚਾਇਆ ਜਾਵੇ ਤਾਂ ਉਹਦੀ ਉੱਥੇ ਹੀ ਮੌਤ ਵੀ ਹੋ ਜਾਂਦੀ ਹੈ ਕਿਉਂਕਿ ਇੰਨੇ ਜ਼ਹਿਰੀਲੇ ਬੂਟੇ ਨੇ ਵੀ ਇੱਕ ਸੈਕਿੰਡ ਵਿੱਚ ਹੀ ਬੰਦੇ ਦੀ ਪੂਰੀ ਬੋਡੀ ਵਿੱਚ ਜ਼ਹਿਰ ਫੈਲਾ ਦਿੰਦੇ ਨੇ ਅਤੇ ਇੱਦਾਂ ਹੀ ਅਸੀਂ ਜਦੋਂ ਮਤਲਬ ਕਿ ਨੀਚ ਉਹ ਮੱਥਾ ਟੇਕ ਕੇ ਨੀਚੇ ਆਏ ਤਾਂ ਅਸੀਂ ਮਤਲਬ ਕਿ ਰਸਤੇ ਵਿੱਚ ਹੀ ਸੀਗੇ ਅਤੇ ਉੱਥੇ ਸਾਨੂੰ ਪਤਾ ਲੱਗਿਆ ਵੀ ਉੱਥੇ ਜਿਹੜਾ ਹੇਮਕੁੰਡ ਸਾਹਿਬ ਵਿੱਚ ਬੱਦਲ ਫਟ ਗਿਆ ਅਤੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਅਸੀਂ ਵਾਲ ਵਾਲ ਬਚੇ ਮਤਲਬ ਕਿ ਕਹਿ ਸਕਦੇ ਹਾਂ ਤੁਸੀਂ ਵੀ ਅਸੀਂ ਇੱਕ ਦਿਨ ਹੀ ਪਹਿਲਾਂ ਆਪਣੇ ਘਰਾਂ ਪਹੁੰਚੇ ਸੀਗੇ ਇਹ ਸਾਰੀ ਘਟਨਾਵਾਂ ਮੈਨੂੰ ਬਹੁਤ ਯਾਦ ਆਉਂਦੀ ਹੈ ਵੀ ਜੇ ਅਸੀਂ ਉੱਥੇ ਫਸ ਜਾਂਦੇ ਤਾਂ ਕੀ ਕੁਛ ਹੋਣਾ ਸੀਗਾ ਕਿਉਂਕਿ ਉਹ ਸਮੇਂ ਜਿਹੜੀ ਪਾਣੀ ਦੀ ਬੋਤਲ ਵੀਹ ਰੁਪਏ ਦੀ ਮਿਲਦੀ ਹੈ ਉਹ ਘੱਟੋ ਘੱਟ ਸੌ ਰੁਪਏ ਦੀ ਮਿਲਣ ਲੱਗ ਗਈ ਸੀਗੀ ਅਤੇ ਖਾਣ ਪੀਣ ਨੂੰ ਤਾਂ ਕੁਛ ਮਿਲਦਾ ਹੀ ਨਹੀਂ ਸੀਗਾ ਉੱਥੇ ਅਤੇ ਉੱਥੇ ਦੇ ਹਾਲਾਤ ਬਹੁਤ ਬੁਰੇ ਹੋ ਗਏ ਸਨ ਇਹ ਸਾਰੀਆਂ ਘਟਨਾਵਾਂ ਮੈਨੂੰ ਬਹੁਤ ਮਤਲਬ ਕਿ ਦਿਲ ਨੂੰ ਝੰਜੋੜਦੀਆਂ ਨੇ